ਹਾਂਜੀ ਦੇਖਿਆ ਜਾਵੇ ਤਾਂ ਕਾਫੀ ਸਾਰਾ ਅੱਜ ਦਾ ਜੋ ਵੀ ਕਲਚਰ ਗਾ ਜੋ ਵੀ ਟੀਵੀ ਦੇ ਉੱਤੇ ਦਿਖਾਇਆ ਜਾਂਦਾ ਗਾ ਜੋ ਵੀ ਆਪਣੀ ਕਲਾਕਾਰੀ ਨੂੰ ਲੋਕਾਂ ਦੇ ਸਾਹਮਣੇ ਕੀਤਾ ਜਾਂਦਾ ਗਾ ਉਹ ਕਾਫੀ ਜ਼ਿਆਦੀ ਅਸ਼ਲੀਲਤਾ ਭਰਿਆ ਹੁੰਦਾ ਗਾ ਸੋ ਅਸ਼ਲੀਲਤਾ ਇੱਕ ਐਸਾ ਏਸ ਐਸਾ ਜ਼ਰੀਆ ਬਣ ਗਈ ਕਲਾਕਾਰੀ ਦੇ ਵਿੱਚ ਜਿਸ ਦੇ ਨਾਲ ਸਮਾਜ ਦੇ ਉੱਤੇ ਕਾਫੀ ਜ਼ਿਆਦਾ ਪ੍ਰਭਾਵ ਪੈਂਦਾ ਆ ਸੋ ਇਹ ਚੀਜ਼ਾਂ ਘੱਟ ਹੋਣੀਆਂ ਚਾਹੀਦੀਆਂ ਅਤੇ ਇਸ ਨੂੰ ਘੱਟ ਪ੍ਰਮੋਟ ਕੀਤਾ ਜਾਵੇ ਘੱਟ ਦੇਖਿਆ ਜਾਵੇ ਤਾਂ ਕਿਤੇ ਇਹ ਘੱਟ ਹੋ ਸਕਦੀ ਹੈ ਸੋ ਅਸ਼ਲੀਲਤਾ ਦੇ ਨਾਲ ਨਾਲ ਖੈਰ ਜ਼ਿਆਦਾਤਰ ਮੋਡਲਸ ਜੋ ਵੀ ਲੜਕੀਆਂ ਜਾਂਦੀਆਂ ਉਹਨਾਂ ਨਾਲ ਬਿਹੇਵ ਵੀ ਚੰਗਾ ਨਹੀਂ ਕੀਤਾ ਜਾਂਦਾ ਅਤੇ ਇਸ ਨੂੰ ਰੋਕਣ ਵਾਸਤੇ ਆਪਾਂ ਚੰਗਾ ਸੁਣੀਏ ਚੰਗਾ ਚੰਗਾ ਦੇਖੀਏ ਤਾਂ ਹੀ ਆਪਣਾ ਵਿਕਾਸ ਹੋ ਸਕਦਾ ਗਾ ਆਪਣੇ ਸਮਾਜ ਦਾ